ਮੌਜੂਦਾ ਰੁਝਾਨਾਂ ਨਾਲ ਜੁੜੇ ਰਹਿਣ ਲਈ ਮੈਂ ਵੱਖ ਵੱਖ ਫੋਟੋਗ੍ਰਾਫੀਆਂ ਪ੍ਰਦਰਸ਼ਨੀਆਂ ਜਾਂ ਗੈਲਰੀਆਂ ਵਿੱਚ ਹਾਜ਼ਰ ਹੋਈ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਵੱਖ ਵੱਖ ਫੋਟੋਗ੍ਰਾਫੀਆਂ ਜਾਂ ਆਰਟ ਗੈਲਰੀਆਂ ਨੂੰ ਦੇਖਾਂਗੇ ਤਾਂ ਸਾ ਸਾਡੇ ਮੌਜੂਦਾ ਰੋਜ਼ਾਨਾ ਨਾਲੋਂ ਅਸੀਂ ਜੁ ਜੁੜ ਸਕਦੇ ਹਾਂ ਕਿਉਂਕਿ ਸਾਡੇ ਬਹੁਤ ਬਹੁਤ ਰੁਜ਼ਗਾਰ ਚਲਦੇ ਹਨ ਜਿਸ ਨਾਲ ਸਾਨੂੰ ਟਾਈਮ ਨਹੀਂ ਮਿਲਦਾ ਕਿ ਅਸੀਂ ਕਿਤੇ ਜਾ ਕੇ ਘੁੰਮੀਏ ਇਸ ਨਾਲ ਅਸੀਂ ਫੋਟੋਗ੍ਰਾਫੀਆਂ ਪ੍ਰਦਰਸ਼ਨੀਆਂ ਨਾਲ ਅਸੀਂ ਘੁੰਮ ਵੀ ਸਕਦੇ ਹਾਂ ਅਤੇ ਸਾਡਾ ਮਨੋਰੰਜਨ ਵੀ ਹੋ ਜਾਂਦਾ ਹੈ ਜਿਸ ਨਾਲ ਸਾਡਾ ਸਾਨੂੰ ਹੋਰ ਵੀ ਹੁੰਦਾ ਹੈ ਕਿ ਅਸੀਂ ਹੋਰ ਵੀ ਕਿਤੇ ਹੋਰ ਜਾ ਕੇ ਫੋਟੋਗ੍ਰਾਫੀਆਂ ਜਾਂ ਦੇਖੀਏ ਇਸ ਨਾਲ ਸਾਡਾ ਮਨ ਜਿਹੜਾ ਉਹ ਕੰਮ ਤੋਂ ਟੁੱਟ ਕੇ ਅਸੀਂ ਬਹੁਤ ਮਨੋਰੰਜਨ ਕਰਦੇ ਹਾਂ ਇਸ ਨਾਲ ਜਿ ਜਿਹੜਾ ਸਾਡਾ ਉਹ ਮਨ ਆ ਉਹ ਹੋਰ ਵੀ ਚਾਹੁੰਦਾ ਹੈ ਕਿ ਅਸੀਂ ਹੋਰ ਵੀ ਬਹੁਤ ਸਾਰਾ ਕੁਝ ਦੇਖੀਏ ਜਿਸ ਨਾਲ ਸਾਡੀ ਜਿਹੜੀ ਨੌਲੇਜ ਆ ਉਹ ਵੀ ਵਧੀਆ ਹੋ ਸਕੇ ਇਸ ਨਾਲ